ਸਾਡੇ ਆਲੇ ਦੁਆਲੇ ਨੂੰ ਸਾਫ ਰੱਖਣ ਦੇ ਲਈ ਸਾਡੇ ਪਿੰਡ ਦੇ ਸਰਪੰਚ ਅਤੇ ਮੋਹਤਬਾਰਾਂ ਨੇ ਰੂੜੀਆਂ ਅਤੇ ਨਿਕਾਸ ਦੇ ਲਈ ਵਾਰ ਵਾਰ ਟੋਏ ਪਟਵਾਏ ਹੋਏ ਆ ਤਾਂ ਜੋ ਉਸੀ ਰੂੜੀਆਂ ਨੂੰ ਉਸਦੇ ਵਿੱਚ ਹੀ ਸੁੱਟ ਸਕੀਏ ਅਤੇ ਸਾਡੇ ਪਿੰਡ ਦੇ ਬਾਹਰ ਬਾਹਰ ਦੋ ਵੱਡੇ ਕੂੜੇ ਦੇ ਡਰੰਮ ਲਗਵਾਏ ਹੋਏ ਹਨ ਅਸੀਂ ਉਸ ਦੇ ਵਿੱਚ ਇੱਕ ਵਿੱਚ ਸੁੱਕਾ ਕੂੜਾ ਅਤੇ ਦੂਸਰੇ ਵਿੱਚ ਗਿੱਲਾ ਕੂੜਾ ਸੁੱਟਦੇ ਹਨ ਅਸੀਂ ਉਸ ਕੂੜੇ ਨੂੰ ਬਾਅਦ ਵਿੱਚ ਖਾਦ ਦੇ ਰੂਪ ਵਿੱਚ ਤਿਆਰ ਕਰਕੇ ਖੇਤਾਂ ਵਿੱਚ ਪਾਉਂਦੇ ਹਾਂ ਪਾਣੀ ਦਾ ਨਿਕਾਸ ਸਾਡੇ ਪਿੰਡ ਵਿੱਚ ਪਾਣੀ ਦਾ ਨਿਕਾਸ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਨਾਲੇ ਰਾਹੀਂ ਅਤੇ ਦੂਸਰਾ ਸੀਵਰੇਜ ਰਾਹੀਂ ਜਿਹੜਾ ਸਾਡੇ ਪਿੰਡ ਵਿੱਚ ਵਾਧੂ ਘਾਟੂ ਪਾਣੀ ਹੁੰਦਾ ਹੈ ਉਸ ਨੂੰ ਅਸੀਂ ਬਾਅਦ ਦੇ ਵਿੱਚ ਸਿੰਚਾਈ ਦੇ ਰੂਪ ਵਿੱਚ ਖੇਤਾਂ ਨੂੰ ਦਿੰਦੇ ਹਾਂ ਅਤੇ ਜੜੀ ਬੂਟੀਆਂ ਜਿਹੜੀਆਂ ਕਾਫੀ ਘਾ ਵਾਧੂ ਘਾਟੂ ਬੂਟੇ ਉੱਗ ਪੈਂਦੇ ਹਨ ਅਸੀਂ ਉਸ ਨੂੰ ਛਿੜਕਾ ਰਾਹੀਂ ਖ਼ਤਮ ਕਰ ਦਿੰਦੇ ਹਾਂ ਤਾਂ ਜੋ ਵਾਧੂ ਘਾਟੂ ਕੋਈ ਜੀਵ ਜੰਤੂ ਸੱਪ ਸਲੂੰਗਾ ਪੈਦਾ ਨਾ ਹੋ ਸਕੇ ਪੌਦੇ ਸਾਡੇ ਪਿੰਡ ਦੇ ਬਾਹਰ ਬਾਹਰ ਅਸੀਂ ਬਹੁਤ ਸਾਰੇ ਪੌਦੇ ਲਗਵਾਏ ਹੋਏ ਹਨ ਤਾਂ ਜੋ ਸਾਡਾ ਵਾਤਾਵਰਨ ਸਾਫ਼ ਸੁਥਰਾ ਰਹਿ ਸਕੇ ਧੰਨਵਾਦ